ਮਹਾਨ ਖੇਡ ਤੋਂ ਇਲਾਵਾ ਇੱਕ ਚੰਗੀ ਖੇਡ ਨੂੰ ਸੈੱਟ ਕਰਨ ਦਾ ਤੱਤਪਰ ਇਹ ਹੋ ਸਕਦਾ ਹੈ ਕਿ ਜਿਵੇਂ ਕੋਈ ਮਹਾਨ ਖਿਡਾਰੀ ਹੋਵੇ ਜਾਂ ਮਹਾਨ ਗੇਮ ਹੋਵੇ ਖੇਡ ਹੋਵੇ ਜਿਵੇਂ ਸਾਡੇ ਕਹਿ ਲਓ ਕੁਸ਼ਤੀਆਂ ਹੁੰਦੀਆਂ ਪੰਜਾਬ ਦੇ ਵਿੱਚ ਜਾਂ ਇਹਨੂੰ ਆਪਾਂ ਰੈਸਲਿੰਗ ਵੀ ਕਹਿ ਸਕਦੇ ਹਾਂ ਇਸ ਕਰਕੇ ਚੰਗੀ ਗੇਮ ਨੂੰ ਸੈੱਟ ਕਰਨਾ ਜ਼ਰੂਰੀ ਹੈ ਮਹਾਨ ਗੇਮ ਨੂੰ ਸੈੱਟ ਕਰਨਾ ਉਹਨੂੰ ਮਹਾਨ ਬਣਾਉਣਾ ਇਹ ਬਹੁਤ ਹੀ ਜ਼ਿਆਦਾ ਥੱਲੜੇ ਲੈਵਲ ਤੋਂ ਸ਼ੁਰੂ ਹੋ ਜਾਂਦਾ ਹੈ ਜਿਵੇਂ ਕਿ ਸਾਡੇ ਖਿਡਾਰੀ ਪਹਿਲਾਂ ਕੱਚੇ ਥਾਵਾਂ 'ਤੇ ਖੇਡਦੇ ਰਹੇ ਨੇ ਕੁਸ਼ਤੀਆਂ ਕਰਦੇ ਰਹੇ ਨੇ ਤਾਂ ਉਹ ਹੌਲੀ ਹੌਲੀ ਜਾ ਕੇ ਮੈਟਾਂ ਵਿੱਚ ਲੜਨ ਲੱਗ ਪਏ ਮੈਟਾਂ ਦੇ ਵਿੱਚ ਕੁਸ਼ਤੀਆਂ ਹੋਣ ਲੱਗ ਪਈਆਂ ਜਿਹਦੇ ਕਰਕੇ ਇੱਕ ਗੇਮ ਨੂੰ ਚੰਗੀ ਤਰ੍ਹਾਂ ਸੈੱਟ ਕਰ ਦਿੱਤਾ ਗਿਆ ਹੈ ਪੂਰੇ ਦੁਨੀਆਂ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਰੈਸਲਿੰਗ ਵੀ ਕੋਈ ਗੇਮ ਹੈ ਜਿਹੜੀ ਕਿ ਅਖਾੜਿਆਂ ਤੋਂ ਲੜਨਾ ਸ਼ੁਰੂ ਕੀਤਾ ਸੀ ਅਤੇ ਅੱਜ ਦੇ ਸਮੇਂ ਵਿੱਚ ਵੱਡੇ ਵੱਡੇ ਸਟੇਡੀਅਮਾਂ ਦੇ ਵਿੱਚ ਜਾ ਕੇ ਅਤੇ ਗੱਦਿਆਂ ਵਿੱਚ ਲੜਿਆ ਜਾਂਦਾ ਹੈ ਜਿਹਦੇ ਕਰਕੇ ਇਸ ਗੇਮ ਦੀ ਉਸ ਖੇਡ ਦੀ ਪ੍ਰਸੰਸਾ ਲੋਕਾਂ ਦੇ ਵਿੱਚ ਵੱਧ ਗਈ ਹੈ ਅਤੇ ਉਹ ਹਮੇਸ਼ਾ ਹੀ ਆਪਣੇ ਗੇਮ ਨੂੰ ਲੈ ਕੇ ਆਪਣੇ ਆਪ ਨੂੰ ਲੈ ਕੇ ਜਾਣੇ ਜਾਂਦੇ ਨੇ ਅਤੇ ਇਵੇਂ ਜੇ ਲਗਾਤਾਰ ਆਪਾਂ ਗੇਮਾਂ ਨੂੰ ਸੈੱਟ ਕਰਦੇ ਰਹੇ ਜੇ ਆਪਾਂ ਹਰ ਤਰ੍ਹਾਂ ਦੇ ਚੰਗੇ ਖੇਡਾਂ ਨੂੰ ਵੀ ਮੌਕਾ ਦਿੱਤਾ ਕਿ ਉਹ ਵੀ ਬਾਕੀ ਗੇਮਾਂ ਵਾਂਗ ਖੇਡੇ ਜਾਣ ਅਤੇ ਇਹ ਬਹੁਤ ਹੀ ਵਧੀਆ ਹੋ ਜਾਵੇਗਾ ਅਤੇ ਸਾਰਿਆਂ ਲਈ ਬਹੁਤ ਹੀ ਚੰਗੀ ਭਵਿੱਖ ਲੈ ਕੇ ਆਵੇਗੀ ਤਾਂ ਕਿ ਸਾਰੇ ਬੱਚੇ ਜਿਹੜੇ ਖੇਡਦੇ ਨੇ ਉਹ ਆਉਣ ਵਾਲੇ ਸਮੇਂ ਵਿੱਚ ਕਿਤੇ ਸੈੱਟ ਹੋ ਜਾਣ ਇਸ ਤਰੀਕੇ ਨਾਲ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਚੰਗੀ ਖੇਡ ਨੂੰ ਸੈੱਟ ਕਰਨਾ ਬਹੁਤ ਜ਼ਰੂਰੀ ਹੈ